ਅਸੀਂ ਆਪਣੇ ਘਰ ਵਿੱਚ ਫਿਲਟਰ ਪਾਣੀ ਦੀ ਵਰਤੋਂ ਕਰਦੇ ਹਾਂ ਸਾਰੇ ਪਰਿਵਾਰ ਵਾਲੇ ਫਿਲਟਰ ਪਾਣੀ ਹੀ ਪੀਂਦੇ ਹਨ ਸਾਡੇ ਘਰ ਵਿੱਚ ਐਲ ਜੀ ਕੰਪਨੀ ਦਾ ਫਿਲਟਰ ਲੱਗਿਆ ਹੋਇਆ ਹੈ ਅਸੀਂ ਜਿਸ ਵਿੱਚ ਫਿਲਟਰ ਪਾਣੀ ਆਉਂਦਾ ਹੈ ਕਿ ਅਸੀਂ ਇਹ ਬਹੁਤ ਹੀ ਵਧੀਆ ਕੰਪਨੀ ਦਾ ਫਿਲਟਰ ਹੈ ਇਸ ਦੀ ਸਰਵਿਸ ਹਰ ਮਹੀਨੇ ਹੁੰਦੀ ਆ ਹਰ ਮਹੀਨੇ ਕੰਪਨੀ ਦਾ ਬੰਦਾ ਆ ਕੇ ਇਸਦੀ ਸਰਵਿਸ ਕਰਦਾ ਹੈ ਤੇ ਉਸ ਦਾ ਫਿਲਟਰ ਵਾਲਾ ਪਾਰਟ ਵੀ ਬਦਲ ਕੇ ਜਾਂਦਾ ਹੈ ਹਰ ਮਹੀਨੇ ਸਰਵਿਸ ਦਾ ਲਾਭ ਇਹ ਹੈ ਕਿ ਪਾਣੀ ਦਾ ਪੀ ਐਚ ਲੇਵਲ ਸਹੀ ਰਹਿੰਦਾ ਜੇ ਗੱਲ ਕਰੀਏ ਤਾਂ ਘਰੇਲੂ ਨੁਸਖੇ ਦੀ ਅਤੇ ਅਸੀਂ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਵੀ ਪੀਤਾ ਜਾ ਸਕਦਾ ਹੈ ਪਾਣੀ ਨੂੰ ਉਬਾਲ ਕੇ ਫਿਲਟਰ ਕਰਕੇ ਅਸੀਂ ਆਪਣੇ ਪਾਣੀ ਨੂੰ ਸਹੀ ਕਰ ਸਕਦੇ ਹਾਂ ਉਬਲੇ ਹੋਏ ਪਾਣੀ ਨੂੰ ਠੰਡਾ ਕਰਕੇ ਪੀਣ ਦੇ ਲਾਇਕ ਬਣਾ ਲਿਆ ਜਾਂਦਾ ਹੈ ਅਤੇ ਇਹ ਪਾਣੀ ਪੀਣ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਅਤੇ ਅਸੀਂ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ ਅਤੇ ਰੋਗ ਪ੍ਰਤਿਰੋਧਕ ਸ਼ਮਤਾ ਵੀ ਵਧੀਆ ਰਹਿੰਦੀ ਹੈ ਘਰੇਲੂ ਪਾਣੀ ਦਾ ਨੁਸਖਾ ਵਰਤਣ ਦੇ ਨਾਲ ਅਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਹੀ ਪਾਣੀ ਪੀਣ ਲਈ ਦਿੰਦੇ ਹਾਂ ਕਿ ਉਬਾਲ ਕੇ ਪੀਤਾ ਜਾਵੇ ਸਭ ਤੋਂ ਵਧੀਆ ਧੰਨਵਾਦ